ਜ ਜੇਕਰ ਸੱਭਿਆਚਾਰਕ ਪਛਾਣ ਨੂੰ ਆਕਾਰ ਦੇਣ ਦੀ ਗੱਲ ਕੀਤੀ ਜਾਵੇ ਤਾਂ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਆ ਇਹਨਾਂ ਦਾ ਇਸ ਵਿੱਚ ਕਾਫੀ ਮਹੱਤਵਪੂਰਨ ਰੋਲ ਰਿਹਾ ਹੈ ਗੁਰੂ ਸਾਹਿਬਾਨਾਂ ਦੀ ਸਿੱਖਿਆ 'ਤੇ ਚੱਲ ਕੇ ਮਨੁੱਖ ਨੇ ਕਾਫੀ ਵਿਕਾਸ ਕੀਤਾ ਜੇਕਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਲ ਕਰੀ ਜਾਵੇ ਤਾਂ ਉਹਨਾਂ ਨੇ ਕਿਹਾ ਸੀਗਾ ਨਾਮ ਜਪੋ ਵੰਡ ਛਕੋ ਤਾਂ ਇਸ ਤਰ੍ਹਾਂ ਦੇ ਉਪਦੇਸ਼ ਦੇ ਕੇ ਉਹਨਾਂ ਨੇ ਭਾਈਚਾਰੇ ਨੂੰ ਵਿਕਸਤ ਕੀਤਾ ਹੈ ਜਿਸ ਨਾਲ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ ਉਨ ਉਹਨਾਂ ਨੇ ਸਭ ਨੂੰ ਬਰਾਬਰ ਮੰਨਿਆ ਹੈ ਹੁਣ ਜੇਕਰ ਕੋਈ ਇਤਿਹਾਸਕ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕ ਅਜਿਹਾ ਰਾਜ ਰਿਹਾ ਜਿਸ ਨੇ ਜਿਸ 'ਤੇ ਸਭ ਨੂੰ ਮਾਣ ਹੈ ਉਹਨਾਂ ਦਾ ਰਾਜ ਬਹੁਤ ਚੰਗਾ ਰਾਜ ਸੀ ਜਿਸ ਵਿੱਚ ਕਦੇ ਕਿਸੇ ਨੂੰ ਫਾਂਸੀ ਨਹੀਂ ਹੋਈ ਉਹ ਇੱਕ ਚੰਗੇ ਸਿੱਖ ਸਾ ਸਿੱਖ ਸ਼ਾਸਕ ਸਨ ਉਹਨਾਂ ਦਾ ਰਾਜ ਕਾਫੀ ਵਧੀਆ ਸੀ